ਜੇਕਰ ਭੀੜ ਦੀ ਗੱਲ ਕਰੀਏ ਤਾਂ ਹਰ ਪਾਸੇ ਹਰ ਜਗ੍ਹਾ 'ਤੇ ਸਾਨੂੰ ਅੱਜ ਕੱਲ੍ਹ ਲੋਕਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ ਪਰ ਜੇਕਰ ਮੈਂ ਗੱਲ ਕਰਾਂ ਆਪਣੇ ਖੇਤਰ ਦੇ ਹੋਸਪਿਟਲਾਂ ਦੀ ਤਾਂ ਹੋਸਪਿਟਲ ਭਾਵੇਂ ਸਰਕਾਰੀ ਹੋਏ ਚਾਹੇ ਪ੍ਰਾਈਵੇਟ ਹੋਵੇ ਉਹਨਾਂ ਸਾਰਿਆਂ 'ਚ ਭੀੜ ਹਰ ਪਾਸੇ ਦੇਖਣ ਨੂੰ ਹੀ ਮਿਲਦੀ ਹੈ ਮੈਂ ਆਪਣੇ ਤਜ਼ੁਰਬੇ ਨੂੰ ਸ਼ੇਅਰ ਕਰਨਾ ਚਾਹੁੰਦੀ ਹਾਂ ਕੀ ਮੈਂ ਪਿਛਲੇ ਮੰਡੇ ਨੂੰ ਜਦ ਆਪਣੇ ਨਿੱਜ਼ੀ ਨੇੜੇ ਦੇ ਹੋਸਪਿਟਲ ਗਏ ਦਾ ਉੱਥੇ ਬਹੁਤ ਜ਼ਿਆਦਾ ਭੀੜ ਸੀ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਕਈ ਲੋਕ ਮ ਜਿੱਥੇ ਕਿ ਪਰਚੀਆਂ ਕੱਟਦੇ ਹੈ ਉੱਥੇ ਬੈਠੇ ਖੜ੍ਹੇ ਦੋ ਦੋ ਘੰਟਿਆਂ ਤੋਂ ਖੜ੍ਹੇ ਰਹਿੰਦੇ ਨੇ ਨਾ ਇਹਦੇ ਕਰਕੇ ਬੜੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕੁਝ ਬਜ਼ੁਰਗ ਲੋਕ ਜਿੰਨਾਂ ਕੋਲ ਖੜ੍ਹ ਨਹੀਂ ਹੁੰਦਾ ਹੈਗਾ ਕੁਝ ਇੱਦਾਂ ਦੇ ਇਹ ਇੰਸੀਡੈਂਟ ਹੋ ਜਾਂਦੇ ਆ ਕਿ ਜਿੱਦਾਂ ਪ੍ਰੈਗਨੈਂਟਸ ਲੇਡੀਜ਼ ਦੀਆਂ ਵਾਰੀ ਨਹੀਂ ਆਉਂਦੀ ਹੈਗੀ ਇਹ ਸਾਰਾ ਕੁਝ ਦੇਖਣ ਨੂੰ ਬਹੁਤ ਕੁਛ ਮਿਲਦਾ ਪਰ ਇਹਨਾਂ ਹੋਸਪਿਟਲਾਂ ਦੀ ਭੀੜ ਤੋਂ ਲੋਕ ਬਹੁਤ ਜ਼ਿਆਦਾ ਤੰਗ ਆਏ ਹੋਏ ਆ ਕਿ ਹੋਸਪਿਟਲਾਂ 'ਚ ਹਰ ਬੰਦੇ ਨੂੰ ਹੋਸਪਿਟਲ ਜਾਣਾ ਹੀ ਪੈਂਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਉਹ ਹ ਆਪਣਾ ਟ੍ਰੀਟਮੈਂਟ ਘਰ ਬੈਠਾ ਹੀ ਕਰ ਸਕੇ ਪਰ ਹੋਸਪਿਟਲਾਂ ਦੀ ਭੀੜ ਨੇ ਲੋਕਾਂ ਨੂੰ ਅਕਾ ਕੇ ਰੱਖਿਆ ਪਿਆ ਏ ਅਤੇ ਮੈਂ ਜਿੱਥੋਂ ਤੱਕ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਬਜ਼ੁਰਗ ਲੋਕ ਦੇਖੇ ਹੈ ਜੋ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੁੰਦੇ ਹੈ ਦੋ ਦੋ ਤੋਂ ਤਿੰਨ ਤਿੰਨ ਘੰਟੇ ਖੜ੍ਹੇ ਰਹਿੰਦੇ ਨੇ ਪਰ ਉਹਨਾਂ ਨੂੰ ਕੋਈ ਵੀ ਇੱਦਾਂ ਦਾ ਪੋਜ਼ੀਟਿਵ ਰਿਜ਼ਲਟ ਨਹੀਂ ਮਿਲਦਾ ਕਿ ਜਿਹਦੇ ਕਰਕੇ ਕਈ ਵਾਰੀ ਉਹ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਨੇ ਬਹੁਤ ਸਾਰੇ ਲੋਕ ਇੱਦਾਂ ਦੇ ਨੇ ਜੋ ਆਪਣਾ ਕੰਮਕਾਰ ਛੱਡ ਕੇ ਉਹ ਉਹ ਆਪਣੇ ਕੰਮਾਂ ਲਈ ਹੋਸਪਿਟਲਾਂ 'ਚ ਜਾਂਦੇ ਨੇ ਪਰ ਉਹਨਾਂ ਦੇ ਵੀ ਕੰਮ ਨਹੀਂ ਹੁੰਦੇ ਉਹਨਾਂ ਕਰਕੇ ਉਹਨਾਂ ਨੂੰ ਵਾਪਸ ਆਉਣਾ ਪੈਂਦਾ ਇਹ ਸਾਰੇ ਭੀੜ ਦੇ ਨਤੀਜੇ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਭੀੜ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਹਰ ਹੋਸਪਿਟਲ 'ਚ ਅੱਜ ਕੱਲ੍ਹ ਭੀੜ ਦੇਖਣ ਨੂੰ ਮਿਲਦੀ ਹੋਈ ਹੈ ਭਾਵੇਂ ਉਹ ਸਰਕਾਰੀ ਹੋਵੇ ਭਾਵੇਂ ਉਹ ਪ੍ਰਾਈਵੇਟ